ਕੱਪੜੇ ਧੋਣ ਲਈ ਨਹਾਉਣ ਲਈ ਬਰਤਨ ਧੋਣ ਲਈ ਪੀਣ ਲਈ ਭੋਜਨ ਪਕਾਉਣ ਲਈ ਸਫਾਈ ਆਦਿ ਕੰਮਾਂ ਲਈ ਪਸ਼ੂਆਂ ਨੂੰ ਪਿਲਾਉਣ ਲਈ ਹੋਰ ਵੀ ਵਧੇਰੇ ਵੱਖਰੇ ਵੱਖਰੇ ਕੰਮਾਂ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ